ਸਾਡੇ ਸੱਭਿਆਚਾਰ ਦਾ ਮੁੱਖ ਕਿੱਤਾ ਤਾਂ ਖੇਤੀਬਾੜੀ ਹੈ ਜੀ ਜੋ ਸਾਡੇ ਪੁਰਖ ਕਰਦੇ ਆਏ ਆ ਅੱਜ ਤੱਕ ਅਤੇ ਇਹੀ ਸਾਡਾ ਮੇਨ ਜਿਹਾ ਕਿਉਂਕਿ ਪੰਜਾਬ ਦੀ ਜਿਹੜੀ ਧਰਤੀ ਬੜੀ ਉਪਜਾਊ ਆ ਅਤੇ ਖੇਤੀਬਾੜੀ ਲਈ ਬੜੀ ਅਨੁਕੂਲ ਹੈ ਪਰ ਹੁਣ ਜੋ ਚੀਜ਼ ਮੈਂ ਮਹਿਸੂਸ ਕਰ ਰਹੀ ਹਾਂ ਕਿ ਲੋਕ ਇਸ ਕਿੱਤੇ ਤੋਂ ਬਾਹਰ ਜਾ ਰਹੇ ਹੈ ਕਿਉਂਕਿ ਇੱਕ ਤਾਂ ਵਿਦੇਸ਼ ਜਾਣ ਦਾ ਬੜਾ ਚਲਣ ਚੱਲ ਪਿਆ ਆ ਸੋ ਲੋਕ ਜ਼ਮੀਨਾਂ ਵੇਚ ਕੇ ਆਪਣੀ ਖੇਤੀਬਾੜੀ ਦਾ ਕਿੱਤਾ ਛੱਡ ਛੱਡ ਕੇ ਬਾਹਰ ਜਾਈ ਜਾ ਰਹੇ ਹੈ ਅਤੇ ਇਹ ਬੜੀ ਮ ਮਾੜੀ ਗੱਲ ਆ ਕਿਉਂਕਿ ਸਰਕਾਰਾਂ ਤੋਂ ਜੋ ਹੈਗਾ ਵਧੀਆ ਢੰਗ ਨਾਲ ਰੋਲ ਪਲੇਅ ਨਹੀਂ ਕੀਤਾ ਜਾ ਰਿਹਾ ਬੱਚਿਆਂ ਨੂੰ ਮੋਟੀਵੇਟ ਨਹੀਂ ਕੀਤਾ ਜਾ ਰਿਹਾ ਕਿ ਉਹ ਆਪਣੇ ਕਿੱਤੇ ਨੂੰ ਹੀ ਅਪਣਾਈ ਰੱਖਣ ਕਿਉਂਕਿ ਸਾਡੇ ਕੋਲ ਬਹੁਤ ਵਧੀਆ ਧਰਤੀ ਹੈ ਸਾਡੀ ਪੰਜਾਬ ਦੀ ਪਾਣੀ ਦੀ ਕੋਈ ਕਮੀ ਨਹੀਂ ਹੈ ਸਾਡੀ ਖੇਤੀਬਾੜੀ ਪੂਰੇ ਵਿਸ਼ਵ 'ਚ ਪ੍ਰਸਿੱਧ ਆ ਅਸੀਂ ਕਈ ਚੀਜ਼ਾਂ ਦੇ ਵਿੱਚ ਨਾ ਕਈ ਚੀਜ਼ਾਂ ਦੇ ਉਤਪਾਦਨ ਵਿੱਚ ਤਾਂ ਅਸੀਂ ਪੂਰੇ ਵਿਸ਼ਵ ਵਿੱਚ ਨੰਬਰ ਇੱਕ 'ਤੇ ਹਾਂ ਜਿਵੇਂ ਸਾਡੀ ਕਣਕ ਹੋ ਗਈ ਜਾਂ ਹੁਣ ਕਈ ਚੀਜ਼ਾਂ ਹੋਰ ਵੀ ਹੈਗੀਆਂ ਸੋ ਦੁੱਖ ਲੱਗਦਾ ਹੈ ਕਿ ਜਿਹੜੀ ਸਰਕਾਰਾਂ ਵੱਲੋਂ ਬੇਧਿਆਨੀ ਹੋਣ ਕਰਕੇ ਜਿਹੜੇ ਬੱਚੇ ਹੈ ਜਿਹੜੇ ਅੱਜ ਕੱਲ੍ਹ ਦੀ ਜਨਰੇਸ਼ਨ ਹੈ ਉਹ ਇਹ ਕਿੱਤਾ ਛੱਡੀ ਜਾ ਰਹੀ ਹੈ ਅਤੇ ਬਾਹਰ ਜਾਣ ਨੂੰ ਉਹ ਕਮਰ ਕੱਸ ਰਹੀ ਹੈ ਸੋ ਇਹ ਦੁੱਖ ਦੀ ਗੱਲ ਹੈ ਜੀ